ਗੁਰਦਾਸਪੁਰ ਵਿੱਚ ਕੁੜੀਆਂ ਨੂੰ ਕੋਈ ਸਮੱਸਿਆ ਨਹੀਂ ਕਰਨੀ ਪੈਂਦੀ ਇੱਥੇ ਸਭ ਆਮ ਸਮਾਜ ਦੀ ਤਰ੍ਹਾਂ ਸਾਰੀਆਂ ਕੁੜੀਆਂ ਨੂੰ ਵੀ ਪੜ੍ਹਨ 'ਚ ਸੁਵਿਧਾ ਹੈ ਸਾਰੇ ਆਪਣੇ ਪੇਰੰਸ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ ਕਾਲਜ ਭੇਜਦੇ ਹਨ ਕੰਮ ਕਰਨ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆ ਕੁੜੀਆਂ ਨੇ ਆਪਣੇ ਕੱਪੜਿਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਹੈਗੀਆਂ ਹੋਰ ਵੀ ਬਿਊਟੀ ਪਾਰਲਰ ਦੇ ਵੀ ਕੰਮ ਕੁੜੀਆਂ ਨੇ ਕੀਤੇ ਨੇ ਆਪਣੇ ਸਭ ਕੁਛ ਕੁੜੀਆਂ ਵਾਸਤੇ ਸਮਾਨ ਕੰਮ ਹੈ ਕੋਈ ਇਹਦੇ ਵਿੱਚ ਬੰਦਸ਼ ਨਹੀਂ ਹੈ ਕੁੜੀਆਂ ਨੂੰ ਨਾ ਹੀ ਕੋਈ ਔਰਤਾਂ ਨੂੰ ਇੱਥੇ ਕੋਈ ਪਾਬੰਦੀ ਹੈ ਸਭ ਆਪਣਾ ਆਪਣਾ ਕੰਮ ਆਪਣੇ ਆਪਣੇ ਹਿਸਾਬ ਨਾ ਕਰਦੇ ਹਨ